ਹਾਂਜੀ ਸਰ ਤੁਸੀਂ ਇਲੈਕਟਰੋਨਿਕ ਲੈਪਟੋਪ ਵਗੈਰਾ ਵਾਲੀ ਦੁਕਾਨ ਤੋਂ ਬੋਲ ਰਹੇ ਹੋ ਹਾਂਜੀ ਸਰ ਅਸੀਂ ਤੁਹਾਡੇ ਤੋਂ ਲੈਪਟੋਪ ਲਿਆ ਸੀਗਾ ਸਰ ਉਹਦਾ ਬਹੁਤ ਬੁਰਾ ਹਾਲ ਹੈ ਜੀ ਹਾਂਜੀ ਸਰ ਉਹਦੀ ਸਟੋਰੇਜ ਨਹੀਂ ਸਹੀ ਹੈਗੀ ਸਰ ਹਾਂਜੀ ਉਹਦੀ ਸਕਰੀਨ ਦੀ ਵੀ ਪ੍ਰੋਬਲਮ ਆ ਸਰ ਬੈਂਟਰੀ ਵੀ ਨਹੀਂ ਉਹਦੀ ਜ਼ਿਆਦਾ ਟਾਈਮ ਕੱਢਦੀ ਹਾਂਜੀ ਸਰ ਉਹਦੇ ਵਿੱਚ ਜਿੰਨਾ ਮਰਜ਼ੀ ਡਾਟਾ ਸਟੋਰ ਕਰਕੇ ਰੱਖਿਆ ਹੋਵੇ ਜਦੋਂ ਵੀ ਅਸੀਂ ਦੇਖਦੇ ਹਾਂ ਸਰ ਉਹ ਕਰਪਟ ਹੋ ਜਾਂਦਾ ਡਾਟਾ ਹਾਂਜੀ ਸਰ ਉਹਦੀਆਂ ਜਿੰਨੀਆਂ ਵੀ ਫਾਈਲਾਂ ਨੇਗੀਆਂ ਉਹ ਨਹੀਂ ਸਾਨੂੰ ਲੱਭਦੀਆਂ ਸਰ ਬਹੁਤ ਜ਼ਿਆਦਾ ਪ੍ਰੋਬਲਮ ਹੈ ਜੀ ਇਹਦੇ ਵਿੱਚ ਹਾਂਜੀ ਸਰ ਹੁਣ ਸਾਨੂੰ ਇਹ ਦੱਸੋ ਜੀ ਇਹਦਾ ਹੱਲ ਕੀ ਹੈਗਾ ਲੈਪਟੋਪ ਦਾ ਕੰਮ ਲੈ ਕੰਮ ਹੀ ਨਹੀਂ ਕਰਦਾ ਜੀ ਇਹ ਤਾਂ ਕੋਈ ਵੀ ਬੈਂਟਰੀ ਨਹੀਂ ਬਿਲਕੁਲ ਵੀ ਚਲਦੀ ਬੈਂਟਰੀ ਨਹੀਂ ਚੱਲੂਗੀ ਤਾਂ ਲੈਪਟਾਪ 'ਤੇ ਕੰਮ ਕਿਵੇਂ ਹੋਵੇਗਾ ਹਾਂਜੀ ਸਰ ਸਾਡੀ ਬਹੁਤ ਜ਼ਿਆਦਾ ਮੁਸ਼ਕਲ ਆ ਜੀ ਇਹਦਾ ਕੋਈ ਹੱਲ ਕਰੋ ਸਸਤਾ ਜੀ ਅਕਾਇਆ ਪਿਆ ਜੀ ਤੁਹਾਡੇ ਲੈਪਟੋਪ ਨੇ ਨਾ ਇਹਦੀ ਹਾਂ ਆਹ ਸਟੋਰੇਜ਼ ਸਪੇਸ ਵੀ ਇਹਦੀ ਬਹੁਤ ਜ਼ਿਆਦਾ ਘੱਟ ਹੈ ਕਿ ਕੋਈ ਇਹਦੇ ਵਿੱਚ ਖ਼ਰਾਬੀ ਹੈ ਉਹ ਨਹੀਂ ਸਾਨੂੰ ਪਤਾ ਕਰੈਸ਼ ਹੋ ਜਾਂਦਾ ਸਰ ਬ ਕਰੈਸ਼ ਵੀ ਹੋ ਜਾਂਦਾ ਤੁਸੀਂ ਸਰ ਸਾਡੀ ਰਿਕੁਐਸਟ ਹੈ ਜੀ ਇਹਨੂੰ ਚਾਹੇ ਤਾਂ ਰੀਪਲੇਸ ਕਰੋ ਚਾਹੇ ਅਸੀਂ ਇਹਨੂੰ ਵਾਪਸ ਲਓ ਚਾਹੇ ਇਹਦੇ ਵਿੱਚ ਜੋ ਵੀ ਕੋਈ ਟੈਕਨੀਕਲੀ ਪ੍ਰੋਬਲਮ ਪ੍ਰੋਬਲਮ ਹੈ ਉਹਨੂੰ ਠੀਕ ਕਰੋ ਹਾਂਜੀ ਸਰ ਸਾਨੂੰ ਤਾਂ ਜੀ ਬਹੁਤ ਜ਼ਿਆਦਾ ਦਿੱਕਤ ਆਈ ਜਾਂਦੀ ਹੈ ਜੀ ਸਾ ਅਸੀਂ ਕੰਮ ਹੀ ਸਾਰਾ ਲੈਪਟੋਪ 'ਤੇ ਕਰਨਾ ਹਾਂਜੀ ਇਹਨੇ ਤਾਂ ਬਹੁਤ ਨੈਗੇਟਿਵ ਕੀਤਾ ਪਿਆ ਜੀ ਸਾਨੂੰ ਇਹਨੂੰ ਜਿਵੇਂ ਮਰਜ਼ੀ ਕਰੋ ਤੁਸੀਂ ਇਹ ਲੈਪਟੋਪ ਦਾ ਹੱਲ ਕਰੋ ਰੀਪਲੇਸ ਕਰੋ ਨਹੀਂ ਰੀਪਲੇਸ ਕਰਨਾ ਤਾਂ ਇਹ ਤੁਹਾਡੀ ਟੀਮ ਨੂੰ ਕਹੋ ਵੀ ਇਹਨਾਂ ਨੂੰ ਸਹੀ ਕਰਕੇ ਦਿਓ ਸਾਨੂੰ ਹਾਂਜੀ ਸਰ ਇਹਨੂੰ ਪਲੀਜ਼ ਰਿਕੁਐਸਟ ਹੈ ਜੀ ਇਹਨੂੰ ਠੀਕ ਕਰਵਾ ਕੇ ਦਿਓ ਅਸੀਂ ਬਹੁਤ ਤੰਗ ਆ ਜੀ ਇਹ ਤੋਂ ਜੇ ਤੁਸੀਂ ਇਹ ਹੱਲ ਕਰ ਦਿਓ ਤਾਂ ਤੁਹਾਡਾ ਬਹੁਤ ਧੰਨਵਾਦ ਹੋਵੇਗਾ